ਸਭ ਤੋਂ ਵਧੀਆ ਤਕਨੀਕੀ ਕਹਿ ਕੇ ਸਾਨੂੰ ਸਮਾਲ ਛੋਟੇ ਮਕੈਨੀਕਲ ਇਲੈਕਟਰੋਨਿਕ ਡਿਵਾਈਸ ਅਤੇ ਉਹਨਾਂ ਦੇ ਡਿਜ਼ਾਇਨ ਯੂਜਫੁਲ ਵੀ ਹੁੰਦੇ ਹਨ ਅਤੇ ਪ੍ਰੈਕਟੀਕਲ ਵੀ ਕਰ ਸਕਦੇ ਹਾਂ ਇਹਨਾਂ ਵਿੱਚ ਅਸੀਂ ਤਾਂ ਬਹੁਤ ਅਨੁਭਵ ਕੀਤਾ ਹੈ ਅਸੀਂ ਦਿਨ ਦੇ ਵਿੱਚ ਇੱਕ ਦੂਜੇ ਨਾਲ ਕਨੈਕਟ ਹੋ ਜਾਂਦੇ ਹਾਂ ਇਨਫੋਰਮੇਸ਼ਨ ਮਿਲਦੀਆਂ ਹਨ ਐਂਟਰਟੇਨਮੈਂਟ ਵੀ ਹੁੰਦੇ ਹਨ ਇਹਦੇ ਵਿੱਚ ਟੈਬਲੇਟਸ ਹੈ ਟੋਸਟਰ ਹੈ ਫਲੋਪੀ ਡਿਸਕ ਹੈ ਰੂਟਰ ਹੈ ਕੰਪਿਊਟਰ ਹੈ ਲੈਪਟੋਪ ਨੇ ਇਹ ਟੈਕਨੋਲਜੀ ਨਾਲ ਆਪਾਂ ਹਾਈਟੈਕ ਗੈਗਟਸ ਕਰ ਲੈਂਦੇ ਹਾਂ ਘਰ 'ਤੇ ਗੈਗਟਸ 'ਚ ਕਰ ਲੈਂਦੇ ਹਾਂ ਕਿਚਨ ਦੀਆਂ ਕਰ ਲੈਂਦੇ ਹਾਂ ਅਤੇ ਸਫਾਈ ਗੈਗਟਸ ਵੀ ਕਰ ਲੈਂਦੇ ਹਾਂ ਆਪਾਂ ਨੂੰ ਇਹਦੇ ਵਿੱਚ ਸਮਾਰਟਫੋਨ ਵੀ ਮਿਲ ਜਾਂਦਾ ਹੈ ਟੈਬਲੇਟ ਵੀ ਮਿਲ ਜਾਂਦੀ ਹੈ ਸਮਾਰਟ ਵਾਚਿਸ ਵੀ ਮਿਲ ਜਾਂਦੀਆਂ ਹਨ ਇਸ ਤੋਂ ਵਧੀਆ ਆਪਾਂ ਕਿਸੇ ਤਕਨੀਕੀ ਸਮੱਸਿਆ ਦੇ ਹੱਲ ਵੀ ਕਰ ਲੈਂਦੇ ਹਾਂ ਛੋਟੇ ਛੋਟੇ ਤਕਨੀਕੀ ਉਪਕਰਨ ਹੁੰਦੇ ਹਨ ਡਿਜ਼ਾਇਨ ਕਰ ਲੈਂਦੇ ਹਾਂ ਆਪਾਂ ਉਹਦੇ ਨਾਲ ਮੰਨੋਰੰਜਨ ਵੀ ਕਰ ਲੈਂਦੇ ਹਾਂ ਸਮਾਰਟਫੋਨ ਸਮਾਰਟ ਵੋਚਿਸ ਇਹ ਇੱਕ ਛੋਟਾ ਜਿਹਾ ਉਪਕਰਨ ਹੀ ਹੈ ਜਿਹਨਾਂ ਨਾਲ ਅਸੀਂ ਅਕਸਰ ਆਪਣੇ ਆਪ ਨੂੰ ਨਵੇਂ ਨਵੇਂ ਰੂਪ ਵਿੱਚ ਸਾਂਝਾ ਕਰ ਲੈਂਦੇ ਹਾਂ ਇਹਦੇ ਵਿੱਚ ਲੈਪਟੋਪ ਹੋ ਗਿਆ ਕੰਪਿਊਟਰ ਹੋ ਗਿਆ ਪ੍ਰਿੰਟਰ ਹੋ ਗਿਆ ਡਿਜੀਟਲ ਕੈਮਰਾ ਹੋ ਗਿਆ ਰੂਟਰ ਹੈਡਫੋਨ ਮਾਈਕਰੋਫੋਨ ਵੈਬ ਕੈਮਰਾ ਮਾਊਸ ਮੈਮਰੀ ਕਾਰਡ ਅਸੀਂ ਤਾਂ ਬੜੀਆਂ ਚੀਜ਼ਾਂ ਦੀ ਵਰਤੋਂ ਕਰ ਲੈਂਦੇ ਹਾਂ ਇਹਦੇ ਵਿੱਚ ਮਸ਼ੀਨ ਦੀਆਂ ਵੀ ਕਈ ਉਪਕਰਨ ਹਨ ਜਿਵੇਂ ਬੈਟਰੀ ਯੂ ਐਸ ਬੀ ਫਲੈਸ਼ ਡਰਾਈਵਰ ਕਾਰ ਰੋਕੇਟ ਪਲੇਨ ਫਰਿੱਜ ਕੁੱਕਰ ਵੈਕਿਊਮ ਕਲੀਨਰ ਇਹ ਸਾਡੇ ਵਾਸਤੇ ਬਹੁਤ ਹੀ ਸਹਾਇਤਾ ਕਰਦੇ ਹਨ ਇਹਨਾਂ ਦੀ ਵਿਸ਼ੇਸ਼ਤਾਵਾਂ ਹਨ ਆਪਾਂ ਸਭ ਤੋਂ ਵੱਧ ਆਕਰਸ਼ਿਤ ਹੋ ਜਾਂਦੇ ਹਾਂ ਆਪਾਂ ਘਰ ਬੈਠੇ ਹੀ ਸੌਖੇ ਤੋਂ ਸੌਖੇ ਕੰਮ ਕਰਨ ਲੱਗ ਜਾਂਦੇ ਹਾਂ ਇਹਨਾਂ ਦੀ ਵਰਤੋਂ ਕਰਨ ਨਾਲ ਆਪਾਂ ਨੂੰ ਬਹੁਤ ਹੀ ਆਕਰਸ਼ਨ ਮਿਲਿਆ ਹੈ ਆਪਾਂ ਨੂੰ ਮੋਟਰ ਵਧੀਆ ਵਧੀਆ ਟੈਕਨੋਲੋਜੀਆਂ ਮਿਲਦੀਆਂ ਹਨ ਬਹੁਤ ਹੀ ਸਾਨੂੰ ਸਹਾਇਤਾ ਮਿਲੀ ਹੈ ਇਸ ਨੂੰ ਅਜਮਾਉਣ ਲਈ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਹੈ ਅਨੁਭਵ ਵੀ ਬਹੁਤ ਮਿਲੇ ਹਨ ਅਤੇ ਅਸੀਂ ਇਸ ਤੋਂ ਬਹੁਤ ਹੀ ਵਧੀਆ ਵੱਧ ਤੋਂ ਵੱਧ ਅਕਾ